ਤੇਰਾਂ ਫਰਵਰੀ ਉੱਨੀ ਸੌ ਇਕਾਸੀ ਅੱਠ ਅਗਸਤ ਉੱਨੀ ਸੌ ਤਰਿਆਸੀ ਸੱਤ ਮਾਰਚ ਦੋ ਹਜ਼ਾਰ ਗਿਆਰਾਂ ਛੱਬੀ ਨਵੰਬਰ ਦੋ ਹਜ਼ਾਰ ਗਿਆਰਾਂ ਤੇਰਾਂ ਜੂਨ ਦੋ ਹਜ਼ਾਰ ਤੇਰਾਂ